ਅਸੀਂ ਦੁਪਹਿਰ ਦੇ ਖਾਣੇ ਦੇ ਵਿੱਚ ਦਾਲ ਚੌਲ ਬਣਾਉਂਦੇ ਹਾਂ ਅਸੀਂ ਹੋਰ ਸਬਜ਼ੀ ਕੋਈ ਨਹੀਂ ਬਣਾਉਂਦੇ ਅਤੇ ਇਹ ਸ਼ਾਮ ਦੇ ਸਮੇਂ ਤਾਂ ਅਸੀਂ ਸੁੱਕੀ ਸਬਜ਼ੀ ਬਣਾਉਂਦੇ ਹਾਂ ਅਤੇ ਇਹ ਹੁਣ ਤਾਂ ਸਾਨੂੰ ਕੋਈ ਮਜ਼ਾ ਹੀ ਨਹੀਂ ਆਇਆ ਰੋਟੀ ਖਾਣ ਦਾ ਚੌਲ ਬਣਾਉਣ ਲਈ ਪਤੀਲੇ 'ਚ ਗੜਕਾ ਕੇ ਬਣਾਉਂਦੇ ਹਾਂ ਦਾਲ ਅਸੀਂ ਕੂਕਰ 'ਚ ਸੀਟੀ ਲਵਾਉਂਦੇ ਹਾਂ ਫੁਲਕੇ ਅਸੀਂ ਖਾਂਦੇ ਨਹੀਂ ਹਾਂਜੀ ਦੁਪਹਿਰ ਹੀ ਰਾਤ ਨੂੰ ਫੁਲਕੇ ਖਾਂਦੇ ਹਾਂ ਸਬਜ਼ੀ ਬਣਾ ਲੈਂਦੀ ਹਾਂ ਸੁੱਕੀ ਹਾਂਜੀ ਕੜਾਹੀ 'ਚ ਸਬਜ਼ੀ ਬਣਾ ਲੈਂਦੇ ਹਾਂ ਅਤੇ ਉਹ ਕੁੱਕਰ 'ਚ ਬਣਾ ਲੈਂਦੇ ਹਾਂ ਦਾਲ ਬਣਾਉਣੀ ਹੋਈ ਸ਼ਾਮੀ ਇਹ ਸਵੇਰੇ ਬਸ ਇਹ ਜੇ ਕੋਈ ਮਹਿਮਾਨ ਆਏਦਾ ਹੋਏ ਤਾਂ ਫਿਰ ਅਸੀਂ ਦੋ ਤਿੰਨ ਸਬਜ਼ੀਆ ਬਣਾ ਲੈਂਦੇ ਹਾਂ ਅਤੇ ਫਿਰ ਆ ਸਭ ਕੁਝ ਬਣਾ ਲੈਂਦੇ ਹਾਂ ਜੀ ਹਾਂਜੀ ਦਹੀ ਪਕੌੜੀਆਂ ਸਾਡੇ ਮਹਿਮਾਨ ਖੁਸ਼ ਹੋ ਕੇ ਖਾਂਦੇ ਸਭ ਕੁਝ ਖਾਂਦੇ ਹਾਂ ਅਤੇ ਅਸੀਂ ਬਣਾ ਲੈਂਦੇ ਹਾਂ ਜੀ ਹਾਂਜੀ ਮਟਰ ਪਨੀਰ ਸਭ ਕੁਝ ਬਣਾ ਲੈਂਦੇ ਹਾਂ ਕੋਈ ਨਹੀਂ ਐਸੀ ਗੱਲ ਨਹੀਂ ਹੈ ਹਾਂਜੀ